ਜੀ ਸਤੰਬਰ ਉੱਨੀ ਸੌ ਸਤਾਨਵੇਂ ਦੋ ਜੂਨ ਉੱਨੀ ਸੌ ਅਠਾਨਵੇਂ ਛੱਬੀ ਅਗਸਤ ਦੋ ਹਜ਼ਾਰ ਤੇਈ ਵੀਹ ਜੂਨ ਉੱਨੀ ਸੌ ਸਤਾਨਵੇਂ ਪੰਜ ਅਕਤੂਬਰ ਉੱਨੀ ਸੌ ਛਿਆਨਵੇਂ